ਕੋਈ ਐਸ ਸਚ ਤਾਂ ਮੇਰੀ ਕੋਈ ਯਾਦਗਾਰ ਨਹੀਂ ਹੈਗੀ ਅਨੁਭਵ ਨਹੀਂ ਹੈਗਾ ਮੇਰਾ ਕਿ ਮੈਂ ਜੋ ਚਿੱਤਰਕਾਰੀ ਕਰੇ ਸਮੇਂ ਜਨਤਕ ਤੌਰ 'ਤੇ ਕੀਤਾ ਹੋਵੇ ਪਰ ਹਾਂ ਇੰਨਾਂ ਜ਼ਰੂਰ ਹੈ ਕਿ ਮੈਂ ਆਪਣੇ ਆਪ ਲਈ ਕਰਦੀ ਹਾਂ ਅਤੇ ਮੈਨੂੰ ਇਹ ਅੱਛਾ ਲੱਗਦਾ ਹੈ ਅਤੇ ਮੈਂ ਇਹਨੂੰ ਆਉਣ ਵਾਲੇ ਸਮੇਂ 'ਚ ਵੀ ਕਰਦੀ ਹੀ ਰਹਾਂਗੀ ਧੰਨਵਾਦ